ਸਾਡੇ ਸੱਭਿਆਚਾਰ ਵਿੱਚ ਮੁੱਖ ਕਿੱਤਾ ਗਾ ਇੱਕ ਤਾਂ ਜਿਵੇਂ ਭੰਗੜੇ ਨੂੰ ਲੈ ਕੇ ਲਾ ਲਓ ਤੇ ਇੱਕ ਭੰਗੜਾ ਵਾ ਗਿੱਧਾ ਵਾ ਅਤੇ ਇੱਕ ਖੇਤੀਬਾੜੀ ਆ ਅਤੇ ਜਿਹੜੇ ਸਾਡੇ ਲੋਕ ਵਾ ਉਹ ਚਾਹੁੰਦੇ ਆ ਕਿ ਇਹਦੇ ਵਿੱਚੋਂ ਜ਼ਿਆਦਾਤਰ ਲੋਕ ਬਾਹਰ ਚਲ ਗਏ ਆ ਵੀ ਅਸੀਂ ਆਪਣੀ ਸੱਭਿਆਚਾਰ ਛੱਡ ਕੇ ਅਤੇ ਅਸੀਂ ਬਾਹਰ ਜਾ ਕੇ ਕੰਮ ਕਰਨਾ ਪਸੰਦ ਕਰਦੇ ਹਾਂ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਉਹਨਾਂ ਨੂੰ ਇੱਥੇ ਕੰਮ ਦੀ ਬੜੀ ਤੰਗੀ ਆਉਂਦੀ ਆ ਇਹ ਇਸ ਕਰਕੇ ਜਾਂਦੇ ਆ ਵੀ ਜੀ ਉਹਨਾਂ ਨੂੰ ਕੰਮ ਨਹੀਂ ਇੱਥੇ ਮਿਲਦਾ ਅਤੇ ਕੰਮ ਨਾ ਹੋਣ ਕਰਕੇ ਉਹ ਬਾਹਰ ਜਾਣ ਨੂੰ ਬੱਚੇ ਤਿਆਰ ਰਹਿੰਦੇ ਆ ਵੀ ਪੜ੍ਹ ਲਿਖ ਕੇ ਦਸ ਬਾਰਾਂ ਕਲਾਸਾਂ ਕਰਕੇ ਉਹ ਬਾਹਰ ਚਲੇ ਜਾਂਦੇ ਆ ਵੀ ਅਸੀਂ ਬਾਹਰ ਜਾ ਕੇ ਕੋਈ ਕੰਮ ਕਰ ਸਕੀਏ ਕੋਈ ਰੋਜੀ ਰੋਟੀ ਕਮਾ ਸਕੀਏ ਇੱਥੇ ਸੱਭਿਆਚਾਰ ਵਾਲੇ ਕੰਮ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਸਾਡੀ ਘਰ ਦੇ ਕੰਮ ਨਹੀਂ ਪੂਰੇ ਹੁੰਦੇ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਜਿਹਦੇ ਨਾਲ ਬੱਚਿਆਂ ਨੂੰ ਤੰਗੀ ਹੁੰਦੀ ਆ ਉਹ ਚਾਹੁੰਦੇ ਆ ਕਿ ਅਸੀਂ ਖੁੱਲ੍ਹਾ ਖਾਈਏ ਖੁੱਲ੍ਹਾ ਪੀਈਏ ਅਤੇ ਇੱਥੇ ਉਹਨਾਂ ਨੂੰ ਇਹ ਚੀਜ਼ ਦੀ ਤੰਗੀ ਮਹਿਸੂਸ ਹੁੰਦੀ ਆ ਖਾਣ ਪੀਣ ਦੀ ਜਾਂ ਕੱਪੜੇ ਦੀ ਜਾਂ ਪੈਸੇ ਦੀ ਤੰਗੀ ਹੁੰਦੀ ਬਹੁਤ ਜ਼ਿਆਦਾ ਜਿਹਨੂੰ ਲੈ ਕੇ ਬੱਚੇ ਬਾਹਰ ਜਾ ਕੇ ਕੰਮ ਕਰਨਾ ਪਸੰਦ ਕਰਦੇ ਆ ਅਤੇ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਆ